ਮੇਰੀ ਪਤਨੀ ਨੇ ਇੱਕ ਬੈਡ ਸ਼ੀਟ ਮੰਗਵਾਈ ਸੀਗੀ ਜਿਸ ਦੇ ਨਾਲ ਦੋ ਪਿੱਲੋ ਉਹ ਪਿਓਰ ਕਾਟਨ ਦੇ ਔਡਰ ਕੀਤਾ ਸੀ ਮਿਸ਼ੋ 'ਤੇ ਲੇਕਿਨ ਉਹਨਾਂ ਨੇ ਮਿਕਸ ਭੇਜ ਦਿੱਤੀ ਹੋਈ ਜਿਸ ਦਾ ਸਾਈਜ਼ ਕਾਫ਼ੀ ਮਤਲਬ ਛੋਟਾ ਹੈ ਉਹ ਠੀਕ ਤਰ੍ਹਾਂ ਬੈਡ ਉੱਪਰ ਪੂਰੀ ਆ ਵੀ ਨਹੀਂ ਰਹੀ ਅਤੇ ਕੁਆਲਿਟੀ ਪੱਖੋਂ ਕਾਫ਼ੀ ਖਰਾਬ ਆ ਪਹਿਲੇ ਤੋਂ ਉਹਨਾਂ ਦੇ ਡਿਲੀਵਰੀ ਟਾਈਮ ਦੇ ਵਿੱਚ ਕਾਫ਼ੀ ਪਰੇਸ਼ਾਨੀ ਆਈ ਜਿਸ ਸਮੇਂ ਉਹਨਾਂ ਭੇਜਣੀ ਸੀ ਉਸ ਤੋਂ ਕ ਚਾਰ ਦਿਨ ਲੇਟ ਪਹੁੰਚੀ ਉਸ ਤੋਂ ਬਾਅਦ ਉਹਨਾਂ ਦਾ ਜੋ ਡਿਲੀਵਰੀ ਬੋਆਏ ਸੀ ਉਹ ਵੀ ਉਹਦਾ ਵਿਵਹਾਰ ਵੀ ਠੀਕ ਨਹੀਂ ਸੀ ਅਤੇ ਉਹ ਕਿਸੇ ਹੋਰ ਦੇ ਘਰ ਰੱਖ ਕੇ ਚਲਾ ਗਿਆ ਜਿਸ ਤੋਂ ਬਾਅਦ 'ਚ ਫੋਨ ਕਰਨ 'ਤੇ ਪਤਾ ਚੱਲਿਆ ਕਿ ਬੈਡਸ਼ੀਟ ਗੁਆਂਢੀ ਦੇ ਘਰ ਪਈ ਹੋਈ ਹੈ ਜੋ ਲੈ ਕੇ ਦੇਖੀ ਤਾਂ ਉਹਦੀ ਕੁਆਲਿਟੀ ਕਾਫ਼ੀ ਮਾੜੀ ਸੀ ਜਿਸ ਦੇ ਕਾਰਨ ਪੈਸੇ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਉਹ ਸ਼ੀਟ ਵੀ ਪਸੰਦ ਨਹੀਂ ਸੀ